ਭੰਗੜਾ ਪੰਜਾਬ ਦਾ ਇੱਕ ਵਿਸ਼ਵ ਪ੍ਰਸਿੱਧ ਲੋਕ ਨਾਚ ਹੈ ਇਸ ਨੂੰ ਦੁਨੀਆਂਦਾਰੀ ਵਿੱਚ ਰੂਹ ਦੀ ਖੁਰਾਕ ਕਿਹਾ ਜਾਂਦਾ ਹੈ ਇਸ ਨੂੰ ਪਾਉਣ ਲਈ ਲੱਤਾਂ ਅਤੇ ਬਾਹਵਾਂ ਦੀ ਤਾਕਤ ਹੋਣੀ ਚਾਹੀਦੀ ਹੈ ਭੰਗੜੇ ਦੀ ਵਿੱਚ ਬਹੁਤ ਸਾਰੇ ਤਰੀਕੇ ਹੁੰਦੇ ਹਨ ਜਿਹਨਾਂ ਨੂੰ ਸਟੈੱਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਕਿ ਲੁੱਡੀ ਧਮਾਲ ਝੂਮਰ ਮਿਰਜ਼ਾ ਆਦਿ ਕਿਹਾ ਜਾਂਦਾ ਭੰਗੜਾ ਇੱਕ ਅਜਿਹਾ ਨਾਚ ਹੈ ਜਿਸ ਨੂੰ ਪਾ ਕੇ ਮਾਨਸਿਕ ਖੁਸ਼ੀ ਅਤੇ ਫੁਰਤੀ ਮਹਿਸੂਸ ਹੁੰਦੀ ਹੈ ਭੰਗੜੇ ਵਿੱਚ ਅਜਿਹੇ ਨਾਚ ਹੈ ਜਿਸ ਨੂੰ ਕਿ ਜਿਵੇਂ ਵਿਦੇਸ਼ਾਂ ਵਿੱਚ ਵੀ ਬਹੁਤ ਉਤਸ਼ਾਹ ਨਾਲ ਦੇਖਿਆ ਜਾਂਦਾ ਹੈ ਇਸ ਨੂੰ ਸਿਰਫ ਪੰਜਾਬ ਦੀ ਹੀ ਨਹੀਂ ਕੋਈ ਹੋਰ ਕੋਈ ਵੀ ਹਿੰਦੁਸਤਾਨੀ ਜਾਂ ਹੋਰ ਕੋਈ ਵਿਦੇਸ਼ੀ ਵੀ ਦੇਖਦਾ ਹੈ ਤਾਂ ਉਹ ਵੀ ਮਸਤੀ ਵਿੱਚ ਝੂੰਮਣ ਲੱਗਦੇ ਹਨ ਅਤੇ ਪੰਜਾਬ ਪੰਜਾਬੀਅਤ ਵੀ ਤਾਰੀਫ ਕਰਦੇ ਹਾਂ ਜਿਸ ਨੂੰ ਸੁਣ ਕੇ ਭੰਗੜਾ ਪਾਉਣ ਵਾਲੇ ਮੈਂਬਰ ਦਾ ਅਤੇ ਪੂਰੇ ਸਮੂਹ ਦਾ ਸਮੂੁਹ ਦਾ ਉਤਸ਼ਾਹ ਵੱਧਦਾ ਹੈ ਉਹਨਾਂ ਨੂੰ ਆਪਣੇ ਸਮੂਹ ਦਾ ਮੈਂਬਰ ਅਤੇ ਪੰਜਾਬੀ ਹੋਣ 'ਤੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਇਸ ਦੇ ਕੁੱਲ ਮੈਂਬਰ ਕੁਝ ਸਟੈਪ ਜਿਵੇਂ ਕਿ ਮਿਰਜ਼ਾ ਨੂੰ ਪਾ ਕੇ ਪੱਟਾਂ ਦਾ ਜ਼ੋਰ ਦਿਖਾਇਆ ਜਾਂਦਾ ਹੈ ਲੁੱਡੀ ਨੂੂੰ ਪਾ ਕੇ ਮਨ ਦੀ ਤਾਂਘ ਅਤੇ ਖੁਸ਼ੀ ਦਰਸਾਈ ਜਾਂਦੀ ਹੈ ਜਿਸ ਤੋਂ ਸਾਨੂੰ ਬਹੁਤ ਮਾਣ ਹੈ ਕਿ ਭੰਗੜਾ ਅਤੇ ਸਾਡੇ ਸੱਭਿਆਚਾਰ ਦਾ ਹਿੱਸਾ ਹੈ